ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਸੀਂ ਆਰਿਅਨ ਦੇ ਘਰੋਂ ਗੱਲ ਕਰਦੇ ਹੋ ਅ ਮੈਮ ਮੈਂ ਨਾ ਉਨ੍ਹਾਂ ਦੇ ਸਕੂਲ ਤੋਂ ਗੱਲ ਕਰਦੀ ਹਾਂ ਉਹਨਾਂ ਦੀ ਇੰਗਲਿਸ਼ ਦੀ ਟੀਚਰ ਹਾਂ ਮੈਂ ਨਾ ਬੱਚੇ ਦਾ ਮਤਲਬ ਕਿ ਸਾਰੇ ਹੀ ਕਲਾਸ ਦਾ ਅੱਜ ਟੈਸਟ ਹੋਇਆ ਸੀ ਸਾਰਿਆਂ ਦਾ ਫਸਟ ਟਾਈਮ ਅਤੇ ਹੈ ਨਾ ਮੈਮ ਬੱਚੇ ਦੀ ਰਿਪੋਰਟ ਦੇਣੀ ਸੀ ਹਾਂਜੀ ਹਾਂਜੀ ਮੈਮ ਬੱਚੇ ਦਾ ਟੈਸਟ ਹੋਇਆ ਸੀ ਓਵਰਔਲ ਸਾਰਾ ਮਤਲਬ ਕਿ ਵਧੀਆ ਹੀ ਕੀਤਾ ਬੱਚੇ ਨੇ ਪਰ ਜਿਹੜੀ ਬੱਚੇ ਦੀ ਗਰਾਮਰ ਆ ਉਹ ਬਹੁਤ ਜ਼ਿਆਦਾ ਵੀਕ ਹੈ ਮਤਲਬ ਕਿ ਸ਼ੁਰੂ ਤੋਂ ਇਹਨੂੰ ਗਰਾਮਰ ਦੇ ਵਿੱਚ ਪ੍ਰੋਬਲਮ ਆ ਬੱਚੇ ਨੂੰ ਇੰਗਲਿਸ਼ ਦੀ ਅੱਛਾ ਨਹੀਂ ਮਤਲਬ ਕਿ ਥੋੜ ਥੋੜ੍ਹੀ ਜਿਹੀ ਪ੍ਰੋਬਲਮ ਸੀ ਮੈਨੂੰ ਲੱਗਦਾ ਕਿ ਸਟਾਰਟਿੰਗ ਤੋਂ ਬੱਚੇ ਦਾ ਕਨਸੈਪਟ ਨਹੀਂ ਕਲੀਅਰ ਹੋਣਾ ਹੋ ਸਕਦਾ ਕਿ ਸਕੂਲ ਚੇਂਜ ਹੋ ਗਿਆ ਕਿ ਬੱਚੇ ਨੂੰ ਤਾਂ ਥੋੜ੍ਹਾ ਜਿਹਾ ਔਕਵਰਡ ਮਤਲਬ ਕਿ ਅਜੀਬ ਲੱਗਦਾ ਹੋਵੇ ਫੀਲ ਹੁੰਦਾ ਹੋਵੇ ਹਾਂਜੀ ਬਾਕੀ ਉਹ ਬਾਕੀ ਤਾਂ ਸਾਰਾ ਟੈਸਟ ਠੀਕ ਆ ਬਾਕੀ ਬੱਚਿਆਂ ਦੇ ਘਰ ਵੀ ਕੋਲ ਕਰਕੇ ਦੱਸੀ ਆ ਬੱਚਿਆਂ ਬਾਰੇ ਕਿ ਬੱਚੇ ਦੇ ਨੰਬਰ ਕਿਵੇਂ ਬਾਕੀ ਸਾਰਾ ਵਧੀਆ ਟੈਸਟ ਕੀਤਾ ਬੱਚੇ ਨੂੰ ਮਤਲਬ ਗਰਾਮਰ ਦੇ ਵਿੱਚ ਥੋੜ੍ਹੀ ਜਿਹੀ ਮਿਸਟੇਕ ਸੀ ਇਹਨਾਂ ਦੀ ਜੀ ਹਾਂਜੀ ਮੈਂ ਹਾਂਜੀ ਹਾਂਜੀ ਮੈਮ ਬੱਚੇ ਦਾ ਮਤਲਬ ਕਿ ਟਿਊਸ਼ਨ ਵਗੈਰਾ ਲਗਾ ਦਿਓ ਜਾਂ ਬੱਚੇ ਨੂੰ ਤੁਸੀਂ ਪੜ੍ਹਾਦਿਆ ਕਰੋ ਘਰ ਇਹਨਾਂ ਦੇ ਪੇਰੈਂਟਸ ਵੱਡੇ ਸਿਸਟਰ ਹੋਣ ਤਾਂ ਉਹ ਪੜ੍ਹਾਦਿਆ ਕਰਨ ਬੱਚੇ ਨੂੰ ਹਾਂਜੀ ਹਾਂਜੀ ਹਾਂਜੀ ਮੈਮ ਬਾਕੀ ਤਾਂ ਨਾ ਬੱਚਾ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਕਾਫ਼ੀ ਵਧੀਆ ਹੈ ਗੇਮਸ ਦੇ ਵਿੱਚ ਬਹੁਤ ਜ਼ਿਆਦਾ ਪਾਰਟੀਸਪੇਟ ਕਰਦਾ ਆ ਅਤੇ ਮਤਲਬ ਕਿ ਅਸੀਂ ਨਾ ਅੱਗੇ ਮਤਲਬ ਕਿ ਡਿਸਟਿਕ ਲੈਵਲ 'ਤੇ ਜਾਣਾ ਸੀ ਬੱਚਿਆਂ ਨੂੰ ਲੈ ਕੇ ਇਹਨਾਂ ਦਾ ਮੁਕਾਬਲਾ ਕਰਵਾਉਣਾ ਸੀ ਅੱਗੇ ਆਪਣਾ ਟੇਬਲ ਟੈਨਿਸ ਦੇ ਵਿੱਚ ਤਾਂ ਬੱਚਾ ਕਹਿੰਦਾ ਸੀ ਕਿ ਮੇਰੇ ਘਰਦਿਆਂ ਨੂੰ ਮੇਰੀ ਮਦਰ ਜਾਂ ਮੇਰੇ ਫਾਦਰ ਨੂੰ ਇੱਕ ਵਾਰੀ ਪੁੱਛ ਲਿਓ ਪਰਮਿਸ਼ਨ ਲੈ ਲਿਓ ਇਹਨਾਂ ਤੋਂ ਕਿਉਂਕਿ ਉਹ ਮਨ੍ਹਾ ਕਰਦੇ ਨੇ ਤੁਸੀਂ ਮਨ੍ਹਾ ਕਰਦੇ ਹੋ ਮੈਮ ਕਿ ਜੇ ਬੱਚਾ ਕਿਤੇ ਹੋਰ ਜਾਵੇ ਲੈਵਲ 'ਤੇ ਖੇਡਣ ਲਈ ਅੱਛਾ ਫਿਰ ਮੈਮ ਪਰਮਿਸ਼ਨ ਦੇ ਤੀ ਤੁਸੀਂ ਮਤਲਬ ਕਿ ਲੈ ਕੇ ਚੱਲ ਜੀਏ ਹਾਂਜੀ ਹਾਂਜੀ ਮੈਮ ਫਿਰ ਨਾ ਆਪਣਾ ਪੰਜ ਦਸ ਦਿਨਾਂ ਬਾਅਦ ਨਾ ਇਹਨਾਂ ਨੂੰ ਲੈ ਕੇ ਜਾਣਾ ਆ ਡਿਸਟ੍ਰਿਕਟ ਲੈਵਲ 'ਤੇ ਆਪਣਾ ਬੈਡਮਿੰਟਨ ਦਾ ਕੋਂਪਟੀਸ਼ਨ ਹੋਏਗਾ ਬੱਚੇ ਦਾ ਤਾਂ ਫਿਰ ਅਸੀਂ ਆਰਿਅਨ ਨੂੰ ਵੀ ਨਾਲ ਲੈ ਕੇ ਜਾਵਾਂਗੇ ਹਾਂਜੀ ਮੈਮ ਬਾਕੀ ਬੱਚੇ ਦਾ ਗਰਾਮਰ 'ਤੇ ਧਿਆਨ ਦਿਓ ਔਲ ਓਵਰ ਸਾਰਾ ਵਧੀਆ ਸੀ ਇਹਦਾ ਟੈਸਟ ਠੀਕ ਹੈ ਓਕੇ ਜੀ ਥੈਂਕ ਯੂ ਮੈਮ